ਪੁਰਾਣੇ ਟਾਈਮ ਦੇ ਸਿੱਕੇ ਮੈਨੂੰ ਇਕੱਠੇ ਕਰਨ ਦਾ ਸ਼ੁਰੂ ਤੋਂ ਹੀ ਸ਼ੌਕ ਰਿਹਾ ਮੈਂ ਪੁਰਾਣੇ ਟਾਇਮ ਦੇ ਸਿੱਕੇ ਬਹੁਤ ਇਕੱਠੇ ਕਰਦਾ ਰਿਹਾਂ ਅਤੇ ਜ ਮੇਰੇ ਕੋਲ ਘੱਟੋ ਘੱਟ ਅੱਸੀ ਸਾਲ ਪੁਰਾਣੇ ਸਿੱਕੇ ਵੀ ਇਕੱਠੇ ਕਰੇ ਹੋਏ ਹਨ ਮੌਜੂਦਾ ਟਾਇਮ ਦੀਆਂ ਸਰਕਾਰਾਂ ਦੇ ਸਿੱਕੇ ਵੀ ਸਾਡੇ ਕੋਲ ਪਏ ਹਨ ਅਤੇ ਜੰਗਾਂ ਯੁੱਧਾਂ ਦੇ ਯਾਦਾਂ ਤਾਜ਼ੀਆਂ ਹੋ ਜਾਂਦੀਆਂ ਹਨ ਅਤੇ ਮੇਰੇ ਕੋਲ ਸਿੱਪੀਆਂ ਸਮੁੰਦਰ ਦੀਆਂ ਸਿੱਪੀਆਂ ਅਤੇ ਉੱਥੇ ਜਿਹੜੇ ਸੰਖ ਹੁੰਦੇ ਹਨ ਉਹ ਵੀ ਇਕੱਠੇ ਕਰਕੇ ਰੱਖੇ ਹੋਏ ਹਨ ਅਤੇ ਉਹਦੇ ਯਾਦਾਂ ਤਾਜ਼ਾ ਹੋ ਜਾਂਦੀਆਂ ਜਿੱਥੇ